ਅਸੀਂ ਜ਼ਿਆਦਾਤਰ ਖ਼ਬਰਾਂ ਆਪਣੀ ਮਾਤ ਭਾਸ਼ ਬੋਲੀ ਪੰਜਾਬੀ ਭਾਸ਼ਾ ਵਿੱਚ ਹੀ ਵੇਖਦੇ ਹਾਂ ਜ਼ਿਆਦਾਤਰ ਪੜ੍ਹੇ ਲਿਖੇ ਨਾ ਹੋਣ ਕਰਕੇ ਸਾਨੂੰ ਕਈ ਭਾਸ਼ਾਵਾਂ ਦੀ ਬਹੁਤ ਘੱਟ ਸਮਝ ਆਉਂਦੀ ਹੈ ਇਸ ਕਰਕੇ ਅਸੀਂ ਪੰਜਾਬੀ ਹੀ ਜ਼ਿਆਦਾ ਬੋਲਦੇ ਹਾਂ ਅਤੇ ਟੀ ਵੀ ਚੈਨਲ ਵੀ ਪੰਜਾਬੀ ਦੀ ਵੇਖਦੇ ਹਾਂ ਬਹੁਤ ਸਾਰੇ ਪੰਜਾਬੀ ਖ਼ਬਰਾਂ ਦੇ ਵੀ ਚੈਨਲ ਆਉਂਦੇ ਹਨ ਜਿਵੇਂ ਕਿ ਪੀ ਟੀ ਸੀ ਪੰਜਾਬੀ ਜੀ ਪੰਜਾਬੀ ਪੰਜਾਬੀ ਗੋਲਡ ਪੰਜਾਬ ਪੀ ਟੀ ਸੀ ਸਿਮਰਨ ਆਦਿ ਵੇਖਦੇ ਹਾਂ ਪੰਜਾਬੀ ਅਖ਼ਬਾਰਾਂ ਵੀ ਸਾਡੇ ਘਰ ਆਉਂਦੀਆਂ ਹਨ ਜਿਨ੍ਹਾਂ ਵਿੱਚੋਂ ਅਜੀਤ ਅਖ਼ਬਾਰ ਜੱਗ ਬਾਣੀ ਹਨ ਉਂਝ ਤਾਂ ਅਸੀਂ ਡਿਸ਼ ਟੀ ਵੀ ਲਗਵਾਇਆ ਹੋਇਆ ਹੈ ਅਤੇ ਬਹੁਤ ਸਾਰੇ ਭਾਸ਼ਾਵਾਂ ਦੇ ਚੈਨਲ ਚੱਲਦੇ ਹਨ ਹਿੰਦੀ ਖ਼ਬਰਾਂ ਅਤੇ ਹਿੰਦੀ ਗਾਣਿਆਂ ਦੇ ਚੈਨਲ ਵੀ ਬਹੁਤ ਆਉਂਦੇ ਹਨ ਹੋਰ ਭਾਸ਼ਾਵਾਂ ਦੇ ਜਿਵੇਂ ਕਿ ਅੰਗਰੇਜ਼ੀ ਖ਼ਬਰਾਂ ਦੇ ਚੈਨਲ ਵੀ ਬਹੁਤ ਉਪਲੱਬਧ ਹਨ ਦੂਰਦਰਸ਼ਨ ਦੇ ਬਹੁਤ ਸਾਰੇ ਖੇਤਰੀ ਭਾਸ਼ਾਵਾਂ ਦੇ ਚੈਨਲ ਵੀ ਚੱਲਦੇ ਹਨ ਪਰ ਸਾਨੂੰ ਬਾਕੀ ਭਾਸ਼ਾਵਾਂ ਦੀ ਇੰਨੀ ਸਮਝ ਨਹੀਂ ਆਉਂਦੀ ਇਸ ਲਈ ਅਸੀਂ ਦਰਬਾਰ ਸਾਹਿਬ ਦਾ ਕੀਰਤਨ ਸੁਣਨ ਲਈ ਜਾਂ ਖ਼ਬਰਾਂ ਸੁਣਨ ਲਈ ਪੰਜਾਬੀ ਸਿਮਰਨ ਅਤੇ ਪੰਜਾਬੀ ਦੇ ਚੈਨਲ ਹੀ ਵੇਖਦੇ ਹਾਂ ਹੋਰ ਕੋਈ ਜ਼ਿਆਦਾ ਚੈਨਲ ਵਿੱਚ ਸਾਡਾ ਇੰਟਰਸਟ ਨਹੀਂ ਬਣਦਾ ਮਨੋਰੰਜਨ ਵਾਲੇ ਚੈਨਲ ਜਿਵੇਂ ਕਿ ਡਰਾਮੇ ਫਿਲਮਾਂ ਆਦਿ ਸ ਆਦਿ ਅਸੀਂ ਪੰਜਾਬੀ ਵਿੱਚ ਹੀ ਪਸੰਦ ਕਰਦੇ ਹਾਂ